ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਾਨਕ ਸਿੱਖਿਆ ਅਤੇ ਸਿੱਖਣ ਦੇ ਮੌਕੇ ਵਧੇਰੇ ਉਪਲਬਧ ਹਨ ਅਤੇ ਇਹਨਾਂ ਦੇ ਵਿੱਚ ਕਾਲਜ ਯੂਨੀਵਰਸਿਟੀਆਂ ਵਧੇਰੇ ਹਨ ਜਿਹਦੇ ਵਿੱਚ ਲੈਂਬਰ ਟੈੱਕ ਸਕਿੱਲ ਯੂੂਨੀਵਰਸਿਟੀ ਬਲਰਾਜ ਕੋਲਜ ਕੇ ਸੀ ਗਰੁੱਪ ਆੱਫ ਕਾਲਜ ਇਹਨਾਂ ਦੀ ਪੜ੍ਹਾਈ ਸ ਉਚੇਰੇ ਢੰਗ ਦੀ ਹੈ ਅਤੇ ਵਧੀਆ ਗਾਈਡੈਂਸ ਹੈ ਇੱਥੇ ਗੁਰੂ ਨਾਨਕ ਕੋਲਜ ਫੌਰ ਵੂਮੈਨ ਇਸ ਇਸ ਦੀ ਪੜ੍ਹਾਈ ਵਧੇਰੇ ਹੈ ਅਤੇ ਸਹੀ ਉੱਚੇ ਲੈਵਲ ਦੀ ਹੈ ਬੀ ਕੇ ਐੱਮ ਕੋਲਜ ਫੋਰ ਐਜੂਕੇਸ਼ਨ ਇਹ ਕੋਲਜ ਦੇ ਵਿੱਚ ਸਪੋਰਟਸ ਪਰਸਨ ਅਤੇ ਪਲੇਸਮੈਂਟ ਕੈਂਪ ਵਧੇਰੇ ਲਗਾਏ ਜਾਂਦੇ ਹੈ ਅਤੇ ਵਧੀਆ ਪੜ੍ਹਾਈ ਹੈ ਅਤੇ ਰਾਇਤ ਪੋਲੀਟੈਕਨਿੱਕ ਕੋਲਜ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦਾ ਉੱਚੇ ਦਰਜੇ ਦਾ ਕੋਲਜ ਹੈ ਜਿਸ ਦੇ ਵਿੱਚ ਵਧੇਰੇ ਸਪੋਰਟਸ ਪਰਸਨ ਪੜ੍ਹ ਕੇ ਨਿਕਲਦੇ ਹਨ ਅਤੇ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ ਇਸ ਦੀ ਪੜ੍ਹਾਈ ਬਾਕੀ ਜ਼ਿਲ੍ਹਿਆਂ ਨਾਲੋਂ ਅੱਬਲ ਹੈ ਅਤੇ ਇੱਥੇ ਸਰਕਾਰੀ ਸਕੂਲਾਂ ਦਾ ਹਾਲ ਬਾਕੀ ਜ਼ਿਲ੍ਹਿਆਂ ਦੇ ਸਕੂਲਾਂ ਨਾਲੋਂ ਵਧੇਰੇ ਸੁਚਾਰੂ ਪ੍ਰਣਾਲੀ ਦਾ ਹੈ ਅਤੇ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ